ਭੰਗੜਾ ਸਾਡੀ ਪੰਜਾਬੀ ਸੱਭਿਆਚਾਰ ਦੀ ਸ਼ਾਨ ਅਤੇ ਆਤਮਾ ਹੈ ਇਹ ਸਿਰਫ ਇੱਕ ਨੱਚਣ ਗਾਉਣ ਦੀ ਕਲਾ ਨਹੀਂ ਸਗੋਂ ਸਾਡੀ ਧਰਤੀ ਦੀ ਖੁਸ਼ਬੂ ਸਾਡੀ ਜੋਸ਼ੀਲੀ ਰੂਹ ਅਤੇ ਸਾਡੇ ਮਿਹਨਤੀ ਸੁਭਾਹ ਦੀ ਨਿਸ਼ਾਨੀ ਹੈ ਭੰਗੜਾ ਐਰੋਬਿਕਸ ਨੇ ਏਸ ਨਾਚ ਨੂੰ ਆਧੁਨਿਕ ਜੀਵਨ ਸ਼ੈਲੀ ਨਾਲ ਜੋੜ ਕੇ ਸਾਡੇ ਤੰਦਰੁਸਤ ਜੀਵਨ ਵਾਸਤੇ ਇੱਕ ਸ਼ਾਨਦਾਰ ਮੰਚ ਮੁਹੱਈਆ ਕਰਵਾਇਆ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਵਿੱਚ ਲੋਕ ਆਪਣੀ ਸਿਹਤ ਅਤੇ ਤੰਦਰੁਸਤੀ ਵੱਲ ਘੱਟ ਧਿਆਨ ਦਿੰਦੇ ਹਨ ਭੰਗੜਾ ਐਰੋਬਿਕਸ ਆਨੰਦ ਅਤੇ ਉਤਸਾਹ ਭਰੀ ਵਿਧੀ ਹੈ ਜੋ ਕਿ ਸਰੀਰਕ ਤੰਦਰੁਸਤੀ ਅਤੇ ਮਨ ਦੀ ਸ਼ਾਂਤੀ ਦੋਵਾਂ ਲਈ ਬਹੁਤ ਲਾਭਦਾਇਕ ਹੈ ਇਹ ਸਾਨੂੰ ਤੰਦਰੁਸਤ ਰੱਖਦਾ ਹੈ ਤਨਾਅ ਦੂਰ ਕਰਦਾ ਹੈ ਅਤੇ ਉਤਸਾਹ ਨਾਲ ਭਰਪੂਰ ਜੀਵਨ ਜੀਉਣ ਲਈ ਪ੍ਰੇਰਿਤ ਕਰਦਾ ਹੈ ਇਹ ਸਾਡੇ ਪੰਜਾਬੀ ਵਿਰਸੇ ਦੀ ਰੱਖਿਆ ਕਰਦੇ ਹਨ ਅਸੀਂ ਅਕਸਰ ਸੁਣਦੇ ਹਾਂ ਕਿ ਨੌਜਵਾਨ ਆਪਣੀ ਜੜਾਂ ਤੋਂ ਦੂਰ ਹੋ ਰਹੇ ਹਨ ਪਰ ਭੰਗੜਾ ਐਰੋਬਿਕਸ ਉਨ੍ਹਾਂ ਲਈ ਇੱਕ ਪੁੱਲ ਬਾਝੋਂ ਕੰਮ ਕਰਦਾ ਹੈ ਇੱਕ ਵਿਧੀ ਜਿਹਦੇ ਨਾਲ਼ ਉਹ ਆਪਣੀ ਮੂਲ ਪਛਾਣ ਨੂੰ ਨਹੀਂ ਭੁੱਲਦੇ ਸਿੱਖਦੇ ਵੀ ਹਨ ਅਤੇ ਆਨੰਦ ਵੀ ਮਾਣਦੇ ਹਨ ਇਹ ਸਾਡੇ ਵਿਰਸੇ ਦੀ ਅਵਾਜ਼ ਬਣਦਾ ਹੈ ਜੋ ਧੂਲ ਢੋਲ ਅਤੇ ਗਿੱਧਾ ਭੰਗੜੇ ਦੀ ਲਹਿਰ ਰਾਹੀਂ ਪੂਰੀ ਦੁਨੀਆਂ ਤੱਕ ਪਹੁੰਚਦੀ ਹੈ ਭੰਗੜਾ ਐਰੋਬਿਕਸ ਇੱਕ ਅਸਲ ਜਸ਼ਨ ਹੈ ਜਿਵੇਂ ਕਿ ਪੰਜਾਬੀ ਜ਼ਿੰਦਗੀ ਦੀ ਹਰ ਖੁਸ਼ੀ ਨੂੰ ਨੱਚ ਗਾਣੇ ਦੇ ਨਾਲ ਮਨਾਉਂਦੇ ਹਨ ਅਤੇ ਇੱਕ ਵੱਡਾ ਜਸ਼ਨ ਹੈ ਇਸ ਨੂੰ ਇਕੱਠੇ ਲਿਆਉਂਦੇ ਹਾਂ ਇਕੱਠੇ ਮਨਾਉਂਦੇ ਹਾਂ ਸਾਡੇ ਵਿੱਚਕਾਰ ਭਾਈਚਾਰਾ ਬਣਦਾ ਹੈ ਅਤੇ ਸਾਡੇ ਅੰਦਰ ਖੁਸ਼ੀ ਭਰ ਦਿੰਦੇ ਹਨ ਇਹ ਸਾਡੇ ਸੋਹਣੇ ਰੰਗ ਰੂਪ ਨੂੰ ਦੁਨੀਆਂ ਅੱਗੇ ਪੇਸ਼ ਕਰਦੇ ਹਨ ਸਾਨੂੰ ਆਪਣੇ ਵਿਰਸੇ 'ਤੇ ਮਾਣ ਹੋਣ ਲਈ ਇੱਕ ਨਵਾਂ ਮੰਚ ਦਿੰਦੇ ਹਨ